ਮੈਂ ਤੁਹਾਡੇ ਰੈਸਟੋਰੈਂਟ ਤੋਂ ਇਡਲੀ ਓਰਡਰ ਕੀਤੀ ਸੀ ਜਿਸ ਦੀ ਜਗ੍ਹਾ 'ਤੇ ਮੈਨੂੰ ਪੀਜ਼ਾ ਮਿਲਿਆ ਈਵਨ ਜੋ ਡਿਲੀਵਰੀ ਕਰਨ ਆਇਆ ਸੀ ਉਹਨਾਂ ਦਾ ਬਿਹੇਵੀਅਰ ਵੀ ਬਹੁਤ ਜ਼ਿਆਦਾ ਰੂਡ ਸੀ ਉਹਨਾਂ ਨੇ ਬੁਹਤ ਹੀ ਬੁਰੇ ਤਰੀਕੇ ਨਾਲ ਮੇਰੇ ਨਾਲ ਗੱਲ ਕੀਤੀ ਈਵਨ ਜੋ ਓਰਡਰ ਸੀ ਉਹ ਵੀ ਟਾਈਮ 'ਤੇ ਨਹੀਂ ਸੀ ਪਹੁੰਚਿਆ ਮੈਂ ਇਹ ਇਡਲੀ ਆਪਨੇ ਗੈਸਟਿਸ ਦੇ ਲਈ ਓਰਡਰ ਕੀਤੀ ਸੀ ਜਦੋਂ ਮੈਂ ਮਤਲਬ ਓਰਡਰ ਆਪਣਾ ਓਪਨ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਇਡਲੀ ਦੀ ਜਗ੍ਹਾ 'ਤੇ ਪੀਜ਼ਾ ਰਿਸੀਵ ਹੋਇਆ ਈਵਨ ਜੋ ਪੀਜ਼ਾ ਸੀ ਉਹ ਵੀ ਸਮੋਲ ਸਾਈਜ਼ ਦਾ ਸੀ ਮੇਰੇ ਗੈਸਟ ਪੀਜ਼ਾ ਨਹੀਂ ਸੀ ਖਾਣਾ ਚਾਹੁੰਦੇ ਈਵਨ ਮੇਰੇ ਪੇਰੈਂਟਸ ਵੀ ਅਤੇ ਮੈਂ ਖੁਦ ਵੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਡਿਸਐਗਰੀ ਹੋਈ ਹਾਂ ਕਿਰਪਾ ਕਰਕੇ ਜਾਂ ਤਾਂ ਜੋ ਮੇਰਾ ਓਰਡਰ ਹੈ ਇਹਨੂੰ ਰੀਪਲੇਸ ਕੀਤਾ ਜਾਵੇ ਮੈਨੂੰ ਇਡਲੀ ਭੇਜੀ ਜਾਵੇ ਨਹੀਂ ਜੋ ਮੈਂ ਪੈਸੇ ਦਿੱਤੇ ਆ ਉਹ ਮੇਰੇ ਰਿਫੰਡ ਕੀਤੇ ਜਾਣ ਕਿਉਂਕਿ ਇਡਲੀ ਦਾ ਜੋ ਪ੍ਰਾਈਜ਼ ਆ ਉਹ ਜ਼ਿਆਦਾ ਆ ਪੀਜ਼ੇ ਦੇ ਨਾਲੋਂ ਈਵਨ ਜੋ